ਪੇਂਟਿੰਗ ਦੇ ਨਾਲ ਨਾਲ ਪੈ ਪੈਨਸਿਲ ਸਕੈਚਿੰਗ ਵੀ ਕਰ ਸਕਦੇ ਹਾਂ ਕਿਉਂਕਿ ਪੇਂਟਿੰਗ ਤੋਂ ਪਹਿਲਾਂ ਮੈਂ ਪੈਨਸਿਲ ਸਕੈਚਿੰਗ ਹੀ ਸਿੱਖੀ ਸੀ ਜਿਹੜੀ ਪੈਨਸਿਲ ਸਕੈਚਿੰਗ ਹੈ ਇਹ ਮੇਰੀ ਕਜ਼ਨ ਨੂੰ ਆਉਂਦੀ ਸੀ ਉਹਨਾਂ ਨੇ ਮੈਨੂੰ ਸਿਖਾਇਆ ਕਿ ਪੇਂਟਿੰਗ ਤੋਂ ਪਹਿਲਾਂ ਸਕੈਚਿੰਗ ਜ਼ਰੂਰੀ ਹੈ ਕਿਉਂਕਿ ਸਕੈਚਿੰਗ ਦੀ ਹੈਲਪ ਨਾਲ ਆਪਾਂ ਕੋਈ ਵੀ ਚੀਜ਼ ਸਕੈਚ ਕਰਨੀ ਡਰਾਇੰਗ ਕਰਨੀ ਕੋਈ ਵੀ ਚੀਜ਼ ਜਿਹਦੀ ਆਊਟਲਾਈਨ ਕਰਨੀ ਜਿਵੇਂ ਮੈ ਫਿਰ ਉਸਨੇ ਮੈਨੂੰ ਸਿਖਾਇਆ ਤਾਂ ਮੈਨੇ ਸੀਨਰੀਜ਼ ਕਾਫੀ ਸਕੈਚ ਕੀਤੀਆਂ ਆਪਣੇ ਮਦਰ ਦਾ ਫਾਦਰ ਦਾ ਸਕੈੱਚ ਕੀਤਾ ਅਤੇ ਉਹਦੇ ਨਾਲ ਮੈਨੂੰ ਜ਼ਿਆਦਾ ਸਕੈਚਿੰਗ ਅੱਛੀ ਲੱਗਣ ਲੱਗ ਗਈ ਤਾਂ ਫਿਰ ਮੈਨੂੰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਤੇਰੀ ਸਕੈਚਿੰਗ ਬਹੁਤ ਅੱਛੀ ਹੈ ਤਾਂ ਫਿਰ ਮੈਨੇ ਉਹਨਾਂ ਨੂੰ ਸਾਰਿਆਂ ਦੇ ਆਪਣੇ ਫਰੈਂਡ ਸਰਕਲ ਦੇ ਆਪਣੇ ਪੇਰੈਂਟਸ ਦੇ ਸਕੈੱਚ ਬਣਾ ਬਣਾ ਕੇ ਗਿਫਟ ਕੀਤੇ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜਦੋਂ ਐਪਰੀਸ਼ੀਏਟ ਕੀਤਾ ਫਿਰ ਮੈਨੂੰ ਲੱਗਿਆ ਕਿ ਮੈਨੂੰ ਪੇਂਟਿੰਗ ਵੀ ਸਿੱਖ ਲੈਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਮੈਨੇ ਜਿਵੇਂ ਪੀਲੋ ਕਵਰਸ ਹੋ ਗਏ ਬੈੱਡ ਸ਼ੀਟਸ ਹੋ ਗਈਆਂ ਇਹ ਸਾਰੀਆਂ ਪੇਂਟਿੰਗ ਕੀਤੀਆਂ ਕਿਉਂਕਿ ਪੇਂਟਿੰਗ ਨਾਲ ਜਿਹੜੀ ਚੀਜ਼ ਹੈ ਉਹ ਉੱਭਰ ਕੇ ਅੱਗੇ ਆਉਂਦੀ ਹੈ ਠੀਕ ਹੈ ਪੇਂਟਿੰਗ ਬਹੁਤ ਦੇਖਣ 'ਚ ਬਹੁਤ ਸੋਹਣੀ ਲੱਗਦੀ ਹੈ ਮੇਨ ਇਹਦੇ ਵਿੱਚ ਕੀ ਜਿਹੜੀ ਪੈਨਸਿਲ ਸਕੈਚਿੰਗ ਹੈ ਆਪਾਂ ਜੇ ਦੋਨਾਂ 'ਚ ਦੇਖੀਏ ਪੈਨਸਿਲ ਸਕੈਚਿੰਗ ਜ਼ਿਆਦਾ ਸੌਖੀ ਵੀ ਹੈ ਔਰ ਕਿਉਂਕਿ ਇਹ ਕੀ ਹੁੰਦਾ ਹੈ ਕਿ ਇਹਨੂੰ ਆਪਾਂ ਰੇਜ਼ ਕਰ ਸਕਦੇ ਹਾਂ ਤਾਂ ਇਸ ਲਈ ਪੈਨਸਿਲ ਸਕੈਚਿੰਗ ਜ਼ਿਆਦਾ ਬੈਸਟ ਹੈ